ਪੰਜਾਬੀ ਸਾਡੀ ਮਾਤ ਭਾਸ਼ਾ ਹੈ ਸਾਡੇ ਗੁਰੂਆਂ ਦੁਆਰਾ ਗੁਰਮੁਖੀ ਦੇ ਰੂਪ ਵਿੱਚ ਸਾਨੂੰ ਇਹ ਭਾਸ਼ਾ ਮਿਲੀ ਹੈ ਇਸ ਭਾਸ਼ਾ ਦਾ ਸਾਡੇ ਸੱਭਿਆਚਾਰ ਉੱਤੇ ਇੱਕ ਅਨੋਖਾ ਪ੍ਰਭਾਵ ਪਿਆ ਹੈ ਅਤੇ ਸਾਡੇ ਸੱਭਿਆਚਾਰ ਸਾਡੇ ਸਮਾਜ ਨੂੰ ਸਾਡੀ ਭਾਸ਼ਾ 'ਤੇ ਮਾਣ ਹੈ ਸਾਡੇ ਹਰੇਕ ਵਿਅਕਤੀ ਦੇ ਵਿਅਕਤੀਤਵ ਉੱਤੇ ਇੱਕ ਅਲੱਗ ਪਹਿਚਾਣ ਦਿਖਾਈ ਦਿੰਦੀ ਹੈ ਜੋ ਪੰਜਾਬ ਜਾਂ ਪੰਜਾਬੀ ਭਾਸ਼ਾ ਨਾਲ ਸੰਬੰਧ ਰੱਖਦਾ ਹੈ